ਪੰਜਾਬ ਵਿੱਚ ਬਹੁਤ ਸਾਰੇ ਪ੍ਰਮੁੱਖ ਸੱਭਿਆਚਾਰਕ ਸਮਾਗਮ ਜਾਂ ਤਿਉਹਾਰ ਮਨਾਏ ਜਾਂਦੇ ਹਨ ਜੋ ਆਪਣੇ ਮਨੋਰੰਜਨ ਮੁੱਲ ਲਈ ਜਾਣੇ ਜਾਂਦੇ ਹਨ ਇਹ ਜਿਵੇਂ ਕਿ ਲੋਹੜੀ ਬਸੰਤ ਪੰਚਮੀ ਹੋਲਾ ਮਹੱਲਾ ਵਿਸਾਖੀ ਅੱਜ ਤੁਹਾਨੂੰ ਮੈਂ ਵਿਸਾਖੀ ਬਾਰੇ ਕੁਝ ਦੱਸਣ ਜਾ ਰਿਹਾ ਹਾਂ ਇਹ ਤਿਉਹਾਰ ਵਿਸਾਖ ਮਹੀਨੇ ਅਪ੍ਰੈਲ ਦੇ ਤੇਰ੍ਹਾਂ ਅਪ੍ਰੈਲ ਨੂੰ ਮਨਾਇਆ ਜਾਂਦਾ ਹੈ ਇਹ ਤਿਉਹਾਰ ਘਰ ਵਿੱਚ ਫਸਲ ਆਉਣ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ ਇਹ ਨਵੇਂ ਸਾਲ ਦੇ ਆਰੰਭ ਨੂੰ ਦਰਸਾਉਂਦਾ ਹੈ ਅਤੇ ਰੋਮਨ ਕੈਲੰਡਰ ਅਨੁਸਾਰ ਤੇਰ੍ਹਾਂ ਅਪ੍ਰੈਲ ਦਾ ਦਿਨ ਹੈ ਉੱਤਰੀ ਭਾਰਤ ਵਿੱਚ ਇਹ ਤਿਉਹਾਰ ਰਬੀ ਦੀ ਫਸਲ ਦੀ ਵਾਢੀ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ ਇਸ ਤਿਉਹਾਰ ਦਾ ਸਿੱਖਾਂ ਲਈ ਵੀ ਬਹੁਤ ਮਹੱਤਤਾ ਹੈ ਕਿਉਂਕਿ ਇਸ ਦਿਨ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਸੌਲ੍ਹਾਂ ਸੌ ਨੜਿਨਵੇਂ ਈਸਵੀ ਵਿੱਚ ਅਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਸਾਜਿਆ ਸੀ